ਚੌਦ੍ਹਾਂ ਦਸੰਬਰ ਦੋ ਹਜ਼ਾਰ ਬਾਈ ਬਾਰ੍ਹਾਂ ਜੁਲਾਈ ਉੱਨੀ ਸੌ ਛਿਆਨਵੇਂ ਸਤਾਈ ਅਗਸਤ ਉੱਨੀ ਸੌ ਅਠਾਨਵੇਂ ਚੌਦ੍ਹਾਂ ਜਨਵਰੀ ਦੋ ਹਜ਼ਾਰ ਚਾਰ ਅੱਠ ਅਕਤੂਬਰ ਦੋ ਹਜ਼ਾਰ ਸਤਾਰ੍ਹਾਂ